ਮੈਂ ਬੁਸ਼ਰਾ ਖਾਤੂਨ ਮੈਂ ਤੁਹਾਡੇ ਟੈਕਸੀ ਸਟੈਂਡ ਸੇ ਇੱਕ ਟੈਕਸੀ ਬੁੱਕ ਕਰਿਆ ਸੀ ਜੋ ਕਿ ਮੈਨੂੰ ਪ੍ਰੇਮ ਨਗਰ ਤੋਂ ਮਨਾਲੀ ਛੱਡਣ ਵਾਲਾ ਸੀ ਪਰ ਹੁਣ ਮੈਨੂੰ ਕਿਸੀ ਮਜ਼ਬੂਰੀ ਦੇ ਕਾਰਨ ਆਪਣੀ ਫ੍ਰੈਂਡ ਦੇ ਘਰ ਜਾਣਾ ਪੈ ਰਿਹਾ ਹੈ ਜਿਸ ਕਰਕੇ ਮੈਂ ਟੈਕਸੀ ਦਾ ਐਡਰੈੱਸ ਚੇਂਜ ਕਰਵਾਉਣਾ ਚਾਹੁੰਦੀ ਹਾਂ ਮੈਂ ਹੁਣ ਰੋਪੜ ਤੋਂ ਮਨਾਲੀ ਜਾਣਾ ਚਾਹੁੰਦੀ ਹਨ ਜਿਸ ਕਰਕੇ ਹੁਣ ਐਡਰੈੱਸ ਚੇਂਜ ਕਰਨਾ ਪੈ ਰਿਹਾ ਹੈ ਮੈਨੂੰ ਮੇਰਾ ਨਵਾਂ ਐਡਰੈੱਸ ਰੋਪੜ ਛੋਟੀ ਹਵੇਲੀ ਹੈ ਆਪਣੇ ਆਪ ਤੁਸੀਂ ਆਪਣੇ ਟੈਕਸੀ ਡਰਾਈਵਰ ਨੂੰ ਛੋਟੀ ਹਵੇਲੀ ਭੇਜ ਦਿਓ ਕਿ ਤਾਂ ਕਿ ਅਸੀਂ ਦੂਸਰੇ ਐਡਰੈੱਸ ਤੋਂ ਮਨਾਲੀ ਜਾ ਸਕੀਏ ਤੁਸੀਂ ਜਿਹੜੇ ਵੀ ਟੈਕਸੀ ਡਰਾਈਵਰ ਨੂੰ ਭੇਜ਼ਣਾ ਹੈ ਉਹ ਇਮਾਨਦਾਰ ਹੋਵੇ ਅਤੇ ਕਿਸੀ ਨਸ਼ੇਆਂ ਦਾ ਪਾਬੰਦ ਨਾ ਹੋਵੇ ਅਤੇ ਉਹਦੀ ਟੈਕਸੀ ਵਿੱਚ ਟਾਇਰ ਵੀ ਚੰਗੇ ਹੋਵੇ ਤਾਂ ਕਿ ਸਾਨੂੰ ਪਹਾੜੀ ਇਲਾਕੇ ਵਿੱਚ ਜਾਣਾ ਹੈ ਅਤੇ ਕਿਸੀ ਦਾ ਮੁਸ਼ਕਲਾਂ ਮਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ